ਜੀ ਸਤਿ ਸ਼੍ਰੀ ਅਕਾਲ ਵੀਰ ਜੀ ਜੀ ਭਾਅ ਜੀ ਮੈਂ ਤੁਹਾਡਾ ਇੰਸਟਾਗਰਾਮ 'ਤੇ ਇੱਕ ਪੇਜ ਫੋਲੋ ਕੀਤਾ ਹੋਇਆ ਸੀ ਜੀ ਉੱਥੋਂ ਤੁਸੀਂ ਸ਼ੂ ਡੀਲਿੰਗ ਕਰਦੇ ਹੋ ਅਤੇ ਉੱਥੋਂ ਦੀ ਨਾ ਮੈਨੂੰ ਇੱਕ ਤੁਹਾਡਾ ਇੱਕ ਸ਼ੂਜ਼ ਬਹੁਤ ਵਧੀਆ ਲੱਗਿਆ ਮੈਂ ਰੈਡ ਟੇਪ ਦੀ ਕੋਂਪਣੀ ਵੇਖ ਰਿਹਾ ਸੀ ਤੁਹਾਡੀ ਉਥੇ ਇੱਕ ਸ਼ੂ ਸੀ ਅਤੇ ਸਨੀਕਰ ਸੀ ਅਤੇ ਉਹ ਮੈਨੂੰ ਹਾਂਜੀ ਹਾਂਜੀ ਉਹ ਬਹੁਤ ਵਧੀਆ ਲੱਗਿਆ ਅਤੇ ਤੁਸੀਂ ਦੱਸ ਸਕਦੇ ਕੀ ਪ੍ਰਾਈਸ ਹੈ ਕੀ ਨਹੀਂ ਜੀ ਮੇਰਾ ਨੰਬਰ ਆ ਪੈਰਾਂ ਦਾ ਅੱਠ ਆਉਂਦਾ ਜੀ ਮੈਨੂੰ ਸਾਈਜ਼ ਪੰਦਰਾਂ ਸੌ ਸੋਲ੍ਹਾਂ ਸੌ ਹੋ ਜੇ ਮੈਨੂੰ ਵੀ ਤੁਹਾਡਾ ਮਤਲਬ ਕਿ ਇੱਕ ਮੇਰਾ ਫਰੈਂਡ ਹੀ ਹੈ ਉਹਨੇ ਰੈਫਰੈਂਸ ਕੀਤਾ ਸੀ ਕਿ ਬਹੁਤ ਵਧੀਆ ਅਗਰ ਜੀ ਤੁਹਾਡੇ ਕੋਲ ਮੈਂ ਮਤਲਬ ਕਿ ਸਨੀਕਰ 'ਚ ਇੱਕ ਸਨੀਕਰ ਲੈਣਾ ਹੋਏ ਰਨਿੰਗ ਸ਼ੂ ਲੈਣੇ ਹੋਏ ਮਤਲਬ ਕਿ ਦੋ ਕੁ ਪੇਅਰ ਲੈਣੇ ਹੋਏ ਤਾਂ ਕੀ ਡਿਸਕਾਊਂਟ ਦਿਉਂਗੇ ਤੁਸੀਂ ਮੈਨੂੰ ਅਗਰ ਮੈਂ ਕਹਿਣਾ ਚਾਹਵਾਂ ਤੁਹਾਨੂੰ ਠੀਕ ਹੈ ਜੀ ਅਤੇ ਆਪ ਜੀ ਦੀ ਲੋਕੇਸ਼ਨ ਕਿੱਥੇ ਆ ਜੀ ਪਠਾਨ ਠੀਕ ਹੈ ਜੀ ਮੈਂ ਵੈਸੇ ਅਗਾੜੀ ਆ ਹੀ ਹੈ ਜੀ ਜੀ ਇਹ ਤਾਂ ਇੱਥੇ ਲਾਗੇ ਹੀ ਹੈ ਹੋਰ ਤੁਸੀਂ ਕੀ ਕੀ ਡੀਲਿੰਗ ਕਰਦੇ ਹੋ ਜੀ ਆਪਣਾ ਕੋਈ ਸ਼ੂ ਦਾ ਹੀ ਸਟੋਰ ਆ ਪੂਰਾ ਚਲੋ ਪਹਿਲੇ ਮੈਂ ਤੁਹਾਡੇ ਕੋਲ ਆਵਾਂਗਾ ਅਤੇ ਬਹੁਤ ਹੀ ਵਧੀਆ ਲੱਗੇ ਸ਼ੂ ਅਤੇ ਆਪਣੇ ਕਾਫੀ ਫਰੈਂਡ ਨੂੰ ਵੀ ਕਹਾਂਗੇ ਜਾਓ ਲਓ ਇਹਨਾਂ ਕੋਲ ਇੱਦਾਂ ਡੀਲਿੰਗ ਚਲਦੀ ਰਹੇਗੀ ਆਪਣੀ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਜੀ